ਗੁਪਤਾ ਇਲੈਕਟਰੋਨ ਤੋਂ ਗੱਲ ਕਰਦੇ ਹੋ ਅਸੀਂ ਤੁਹਾਡੇ ਉਹ ਕੋਲੋਂ ਫੋਨ ਲਿਆ ਸੀਗਾ ਔਰ ਫੋਨ ਇਹ ਬਿਲਕੁਲ ਹੀ ਸੈਟਿਸਫਾਈ ਨਹੀਂ ਆ ਨਾ ਉਹਦੀ ਕੋਈ ਆਵਾਜ਼ ਆਉਂਦੀ ਹੈ ਨਾ ਉਹਦੀ ਕੋਈ ਰੇਂਜ ਆਉਂਦੀ ਆ ਇਸ ਕਰਕੇ ਸਾਨੂੰ ਕਈ ਦੋਸਤਾਂ ਨੇ ਮੈਨੂੰ ਮਨ੍ਹਾ ਕੀਤਾ ਸੀ ਉੱਥੋਂ ਉਹਨਾਂ ਤੋਂ ਫੋਨ ਨਾ ਲਓ ਪਰ ਮੈਂ ਚਲੋ ਤੁਹਾਡਾ ਨਾਂ ਚਲਦਾ ਸੀ ਇਸ ਕਰਕੇ ਤੁਹਾਡੇ ਫੇਸ 'ਤੇ ਲਾ ਲਓ ਜਾਂ ਤੁਹਾਡੇ ਮਤਲਬ ਥੋੜ੍ਹਾ ਵੀ ਲਾ ਲਓ ਚਲੋ ਇਲੈਕਟਰੋਨਕ ਵਧੀਆ ਕੋਂਪਨੀ ਚੱਲ ਰਹੀ ਆ ਅਤੇ ਮੈਂ ਤੁਹਾਡੇ ਕੋਲੋਂ ਮੋਬਾਇਲ ਪਰਚੇਜ ਕੀਤਾ ਪਰ ਉਹ ਮਤਲਬ ਤੁਸੀਂ ਇਹ ਵੇਖ ਲਓ ਵੀ ਨਾ ਤਾਂ ਉਹ ਚੱਲ ਰਿਹਾ ਨਾ ਉਹਦਾ ਕੋਈ ਮਤਲਬ ਹੁਣ ਉਹਦਾ ਕੀ ਕਰੀਏ ਅਤੇ ਕੀ ਨਾ ਕਰੀਏ ਜੇ ਤੁਸੀਂ ਚਾਹੋਗੇ ਵਾਪਸ ਮੋੜ ਲਓਗੇ ਤੁਸੀਂ ਊਂ ਫਿਰ ਗੱਲਾਂ ਕਰਦੇ ਹੋ ਵੀ ਜੇ ਸਹੀ ਹੈ ਜਾਂ ਨਹੀਂ ਆ ਇਸ ਕਰਕੇ ਮਤਲਬ ਪੂਰੇ ਮਜ਼ੇ ਵਾਲੀ ਗੱਲ ਨਹੀਂ ਹੈ ਮੈਂ ਤਾਂ ਹੋਰ ਲੈ ਕੇ ਤੁਹਾਨੂੰ ਫੂਨ ਤੁਹਾਨੂੰ ਹੋਰ ਲੋਕਾਂ ਨੂੰ ਦਿਵਾਉਣੇ ਸੀਗੇ ਪਰ ਮੈਨੂੰ ਇਹ ਫੋਨ ਹੀ ਲੈ ਕੇ ਮਤਲਬ ਮੈਂ ਹੁਣ ਲੋਕਾਂ ਨੂੰ ਕੀ ਕਵਾਂ ਅਤੇ ਨਾ ਕਵਾਂ ਲੋਕਾਂ ਨੂੰ ਤਾਂ ਮੈਂ ਇਹੀ ਕਹਾਂਗਾ ਵੀ ਉਹ ਉੱਥੋਂ ਲੈਣ ਦਾ ਕੋਈ ਫਾਇਦਾ ਨਹੀਂ ਹੈ ਮੈਂ ਤਾਂ ਫਸ ਚੁੱਕਾ ਤੁਸੀਂ ਵੀ ਨਾ ਫਸ ਜਿਓ